ਭੰਗੜਾ ਐਰੋਪਿਕਸ ਕਰਦੇ ਸਮੇਂ ਇੱਕ ਇਹੋ ਜਿਹਾ ਅਨੁਭਵ ਹੁੰਦਾ ਹੈ ਜੋ ਸਾਡੇ ਸਰੀਰ ਤੇ ਮਾਨਸਿਕ ਤੰਦਰੁਸਤੀ ਦੋਵੇਂ ਲਈ ਬਹੁਤ ਲਾਭਦਾਇਕ ਹੁੰਦਾ ਹੈ ਸਰੀਰਕ ਤੌਰ ਤੇ ਇਹ ਇਕ ਉੱਚ ਤੀਬਰਤਾ ਲਈ ਕਾਰੋਡੀਓ ਵਰਕਆਊਟ ਹੈ ਜੋ ਦਿਲ ਦੀ ਧੜਕਨ ਨੂੰ ਤੇਜ ਕਰਦੀ ਹੈ ਸਟੈਮੀਨਾ ਵਧਾਂਦੀ ਹੈ ਅਤੇ ਮਜਬੂਤੀ ਨੂੰ ਵਧਾ ਕੇ ਸਰੀਰ ਨੂੰ ਲਚਕਦਾਰ ਬਣਾਉਂਦੀ ਹੈ ਭੰਗੜਾ ਦੇ ਜੋਸ਼ੀਲੇ ਕਦਮ ਉੱਚੀਆਂ ਛਾਲਾਂ ਅਤੇ ਸ਼ਕਤੀਸ਼ਾਲੀ ਹੱਥਾਂ ਦੀਆਂ ਗਤੀਵਿਧੀਆਂ ਪੂਰੇ ਸਰੀਰ ਨੂੰ ਐਕਟਿਵ ਕਰਦੀਆਂ ਜਿਸ ਨਾਲ ਮਾਂਸਪੇਸ਼ੀਆਂ ਮਜਬੂਤ ਹੋਣੀਆਂ ਹਨ ਤੋਂ ਅਤੇ ਸੰਗਨਪਨ ਵਧਦਾ ਹੈ ਅਤੇ ਸਰੀਰ ਬੈਲਂਸ ਸੁਧਾਰਦਾ ਹੈ ਇਹ ਇੱਕ ਗੁੰਜਲਦਾਰ ਵਰਕਆਊਟ ਹੋਣ ਦੇ ਬਾਵਜੂਦ ਵੀ ਮਨੋਰੰਜਕ ਹੁੰਦਾ ਹੈ ਜਿਸ ਕਰਕੇ ਇਹ ਕਿਸੇ ਭਾਰੀ ਕਸਰਤ ਵਾਂਗ ਥਕਾਵਟ ਭਰੀ ਨਹੀਂ ਲੱਗਦੀ ਲੰਬੇ ਸਮੇਂ ਤੱਕ ਭੰਗੜਾ ਐਰੋਬਿਕਸ ਕਰਨ ਨਾਲ ਮੋਟਾਪਾ ਖੁੱਲਦਾ ਹੈ ਦਿਲ ਦੀ ਤੰਦਰੁਸਤੀ ਬਿਹਤਰੀਨ ਬਣਦੀ ਹੈ ਅਤੇ ਸਰੀਰ ਦੀ ਫੁਰਤੀ ਵਧਦੀ ਹੈ ਜੋ ਕਿ ਆਧੁਨਿਕ ਜਿੰਦਗੀ ਦੀ ਬੈਠਣ ਵਾਲੀ ਰੂਟੀਨ ਵਿੱਚ ਬਹੁਤ ਜਰੂਰੀ ਹੈ ਮਾਨਸਿਕ ਤੌਰ ਤੇ ਭੰਗੜਾ ਐਰੋਬਿਕਸ ਇੱਕ ਸ਼ਾਨਦਾਰ ਧਿਆਨ ਮੁਕਤ ਥੈਰੈਪੀ ਵਾਂਗ ਕੰਮ ਕਰ ਸਕਦਾ ਹੈ ਜਾ ਕੰਮ ਕਰਦਾ ਹੈ ਜਦੋਂ ਅਸੀਂ ਉਚ ਸੁਣਾਈ ਵਾਲੀ ਪੰਜਾਬੀ ਧੁਨ ਤੇ ਭੰਗੜਾ ਕਰਦੇ ਹਾਂ ਤਾਂ ਇਹ ਸਾਡੇ ਮਨ ਚੋ ਨਿਰਾਤਮਕ ਸੋਚਾਂ ਨੂੰ ਦੂਰ ਕਰਕੇ ਖੁਸ਼ਹਾਲੀ ਤੇ ਉਤਸ਼ਾਹ ਦੀ ਭਾਵਨਾ ਉਤਪੰਨ ਕਰਦਾ ਹੈ ਇਹ ਧਿਆਨ ਅਤੇ ਡਿਪਰੈਸ਼ਨ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ ਕਿਉਂਕਿ ਡਾਂਸ ਕਰਦੇ ਹੋਏ ਸਾਡੇ ਦਿਮਾਗ ਚ ਖੁਸ਼ੀ ਦੇ ਹਾਰਮੋਨ ਰਿਲੀਜ਼ ਹੁੰਦੇ ਹਨ ਜੋ ਕਿ ਮਨ ਨੂੰ ਸ਼ਾਂਤ ਅਤੇ ਹਲਕਾ ਮਹਿਸੂਸ ਕਰਾਉਂਦੇ ਹਨ ਇਸ ਤੋਂ ਇਲਾਵਾ ਭੰਗੜਾ ਦੀ ਕੋਰੀਓਗਰਾਫੀ ਯਾਦ ਕਰਨੀ ਅਤੇ ਗਤੀਵਿਧੀਆਂ ਨੂੰ ਸਮਤੋਲ ਤਰੀਕੇ ਨਾਲ ਕਰਨੀ ਦਿਮਾਗ ਦੀ ਕਸਰਤ ਕਰਵਾਦਿਆਂ ਹੈ ਜਿਸ ਨਾਲ ਮੈਮਰੀ ਅਤੇ ਧਿਆਨ ਕੇਂਦਰ ਕਰਨ ਦੀ ਸਮਰਥਾ ਵਧਦੀ ਜਾਂਦੀ ਹੈ ਜਦੋਂ ਅਸੀਂ ਹੋਰ ਲੋਕਾਂ ਨਾਲ ਮਿਲ ਕੇ ਗਰੁੱਪ ਵਿੱਚ ਭੰਗੜਾ ਕਰੀਏ ਤਾਂ ਇਹ ਸਮਾਜਿਕ ਸੰਬੰਧਾਂ ਨੂੰ ਮਜਬੂਤ ਬਣਾਉਂਦਾ ਹੈ ਲੋਕਾਂ ਵਿੱਚ ਭਰੋਸਾ ਵਧਾਉਂਦਾ ਹੈ ਅਤੇ ਇੱਕ ਕਰਤਾ ਦੀ ਭਾਵਨਾ ਪੈਦਾ ਕਰਦਾ ਹੈ